ਹਾਂਜੀ ਮੈਂ ਚੁਣੌਤੀਪੂਰਨ ਮੇਰੇ ਲਈ ਕੱਪੜੇ ਦੀ ਸਿਲਾਈ ਵਿੱਚ ਸੀਗਾ ਕਿ ਮੈਂ ਇੱਕ ਪੁਰਾਣੇ ਸੂਟ ਤੋਂ ਆਪਣੀ ਬੇਟੀ ਦਾ ਸੂਟ ਬਣਾਉਣਾ ਸੀਗਾ ਪੁਰਾਣੇ ਟਾਈਪ ਦੇ ਵਿੱਚ ਜਿਹਦੇ ਵਿੱਚ ਸਲਵਾਰ ਤੋਂ ਉਤਕ ਹਰੀ ਕਟਿੰਗ ਕਰਕੇ ਉਹਦਾ ਉਹਦੇ ਵਿੱਚ ਉਹਦਾ ਲਹਿੰਗਾ ਔਰ ਚੋਲੀ ਬਣਾਉਣੀ ਸੀ ਵਿੱਚੋਂ ਦੁਪੱਟੇ ਵਾਲੀ ਸਾਈਡ 'ਤੇ ਕਿਨਾਰੀ ਵੀ ਮੈਂ ਕੱਢਣੀ ਚਾਹੁੰਦੀ ਸੀ ਅਤੇ ਪਰ ਮੈਂ ਜਿੱਦਾਂ ਮੈਂ ਦੇਖਿਆ ਸੀ ਮਾਰਕੀਟ ਦੇ ਵਿੱਚ ਉਹੋ ਜਿਹੀਆਂ ਲੇਸਿਸ ਲਗਾਉਣ ਲੱਗੇ ਮੈਨੂੰ ਘਰ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਕਿ ਮੈਂ ਹੁਣ ਇਹ ਲੇਸ ਨੂੰ ਕਿੱਦਾਂ ਲਗਾਵਾਂ ਉੱਤੇ ਐਮਬਰਾਇਡਰੀ ਹੋਈ ਹੋਈ ਸੀਗੀ ਅਤੇ ਮਸ਼ੀਨ ਨਾਲ ਲੱਗ ਨਹੀਂ ਸਕਦੀ ਸੀਗੀ ਅਤੇ ਪਹਿਲਾਂ ਤਾਂ ਮੈਂ ਸੂਟ ਦੀ ਸਾਰੀ ਕਟਿੰਗ ਕੀਤੀ ਕਟਿੰਗ ਕਰਕੇ ਉਹਦਾ ਬੇਟੀ ਦਾ ਸ਼ੋਲਡਰ ਵਗੈਰਾ ਸਾਰਾ ਮੈਂ ਸੈਟ ਕੀਤਾ ਵੀ ਉਹਦਾ ਮਤਲਬ ਉਹਦੇ ਹਿਸਾਬ ਨਾਲ ਜਿੰਨੀ ਕੁ ਉਹਦੀ ਹਾਈਟ ਦੇ ਹਿਸਾਬ ਨਾਲ ਹੈ ਨਾ ਅਤੇ ਉਹਦੀ ਚੋਲੀ ਬਣਾ ਲਈ ਅਤੇ ਜਦੋਂ ਫਿਰ ਮੈਂ ਉਸ ਪੁਰਾਣੀ ਸਲਵਾਰ ਦੀ ਕਟਿੰਗ ਕਰਕੇ ਉਹਦੇ ਪੌਂਚੇ ਪੂਚੇ ਅਲੱਗ ਕੀਤੇ ਸਾਰਾ ਅਲੱਗ ਕਰਕੇ ਅਤੇ ਜਦੋਂ ਮੈਂ ਲਹਿੰਗਾ ਬਣਾਉਣ ਲੱਗੀ ਅਤੇ ਉਹ ਮੈਨੂੰ ਸਮਝ ਨਾ ਆਵੇ ਵੀ ਉਹਦੀਆਂ ਸਿਲਾਈਆਂ ਜਿਹੜੀਆਂ ਵਿੱਚ ਸ਼ੋ ਹੋ ਰਹੀਆਂ ਸੀਗੀਆਂ ਸਲਵਾਰ ਦੀਆਂ ਫਿਰ ਮੈਂ ਸਾਰਾ ਉਹਨੂੰ ਉਦੇੜ ਕੇ ਫਿਰ ਉਹਨੂੰ ਮੈਂ ਕਲੀਆਂ ਦੇ ਵਿੱਚ ਬਣਾਇਆ ਕਲੀਆਂ ਦੇ ਵਿੱਚ ਬਣਾ ਕੇ ਫਿਰ ਮੈਂ ਗਲੂ ਲੈ ਕੇ ਇੱਕ ਫੈਬਰਿਕ ਗਲੂ ਆਉਂਦੀ ਸਾਡੇ ਹੈ ਨਾ ਫਿਰ ਮੈਂ ਉਹ ਲਗਾ ਕੇ ਫੈਬਰਿਕ ਗਲੂ ਨਾ ਸਾਰੇ ਮੈਂ ਉਹਦੇ ਵਿੱਚੋਂ ਗੋਟਾ ਵਗੈਰਾ ਲਗਾਇਆ ਸਾਰੀ ਐਮਬਰਾਇਡਰੀ ਵਾਲਾ ਜਿਹੜਾ ਸੀਗਾ ਅਤੇ ਨਾਲ ਫਿਰ ਮੈਂ ਇੱਕ ਨੈੱਟ ਦੀ ਚੁੰਨੀ ਲਿੱਤੀ ਚੁੰਨੀ ਲੈ ਕੇ ਸਾਰਾ ਜਿਹੜਾ ਕੱਪੜਾ ਬਚਿਆ ਸੀਗਾ ਸੂਟ ਦੇ ਨਾਲ ਦਾ ਹੈ ਨਾ ਫਿਰ ਮੈਂ ਉਹਦਾ ਬਾਰਡਰ ਲਗਾ ਕੇ ਫਿਰ ਉਹਦੇ ਲਟਕਣ ਲਗਾਏ ਨੀਚੇ ਬਹੁਤ ਸੋਹਣਾ ਬਣਿਆ ਫਿਰ ਉਹ